ਸਮਾਜਿਕ ਅਤੇ ਨੇਤਿਕ ਮ ਨੈਤਿਕ ਮੁੱਦਿਆਂ ਦੇ ਸਿੱਖ ਧਰਮ ਦੀ ਸਿੱਖ ਧਰਮ ਦੀ ਸਿ ਸਿੱਖਿਆਵਾਂ ਸਤਵਾਂ ਜ਼ਿਆਦਾ ਸੱਭਿਆਚਾਰ ਜਾਚ ਕਾਫੀ ਪ੍ਰਭਾਵਿਤ ਕਰਦੇ ਹਨ ਕਿਉਂਕਿ ਜਿਸ ਸਮੇਂ ਅ ਪੰਜਾਬ ਅਤੇ ਹਿਮਾਚਲ ਵਿੱਚ ਹੜ੍ਹ ਆਏ ਹਨ ਤਾਂ ਇਹਨਾਂ ਲੋਕਾਂ ਨੇ ਗੁਰਦੁਆਰਿਆਂ ਨੇ ਜਾਣੀ ਕਿ ਜਾ ਕੇ ਗਾਹਾਂ ਜਾ ਕੇ ਲੋਕਾਂ ਦੀ ਜਾਣੀ ਕਿ ਮਦਦ ਕੀਤੀ ਲੋਕਾਂ ਨੂੰ ਲੰਗਰ ਲਾਏ ਜਾਣੀ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਇਹਨਾਂ ਕਰਕੇ ਲੋਕ ਇਹਨਾਂ ਨੂੰ ਕਾਫੀ ਪ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਲੋਕਾਂ ਨੇ ਇਹਨਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਜਾਣੀ ਕਿ ਮ ਅ ਧਾਰਮਿਕ ਮੰਨਿਆ ਜੀ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਬਹੁਤ ਜ਼ਿਆਦਾ ਜਾਣੀ ਕਿ ਸੇਵਾ ਕੀਤੀ ਲੋਕਾਂ ਦੀ ਜੋ ਵੀ ਬਿਮਾਰ ਸੀ ਉਹਨਾਂ ਦੀ ਕਾਫੀ ਸੇਵਾ ਕੀਤੀ ਅਤੇ ਸੰਸਥਾਵਾਂ ਬਹੁਤ ਵਧੀਆ ਹਨ ਅਤੇ ਲੋਕ ਇਹਨਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਅਤੇ ਹਰੇਕ ਹ ਹਰੇਕ ਵਿੱਚ ਜਾ ਕੇ ਇੰਨੀ ਹਰੇਕ ਦੀ ਮਦਦ ਕੀਤੀ